ਰਨਿੰਗ ਵਰਕਆਊਟ ਦੀ ਕੋਸ਼ਿਸ਼ ਬਚਪਨ ਤੋਂ ਹੀ ਕੀਤੀ ਹੈ ਜੀ ਜਿਵੇਂ ਸਪਰਿੰਟ ਸ ਹੰਡਰਡ ਮੀਟਰ ਦੋ ਸੌ ਮੀਟਰ ਚਾਰ ਸੌ ਮੀਟਰ ਸੌਲ੍ਹਾਂ ਸੌ ਪੰਜ ਹਜ਼ਾਰ ਮੀਟਰ ਦੀ ਰਨਿੰਗ ਸਪਰਿੰਟ ਵੀ ਲਾਈ ਆ ਸੌ ਦੋ ਸੌ ਦੌੜਨ ਨੇ ਬਹੁਤ ਤੰਦਰੁਸਤੀ ਅਜੇ ਤੱਕ ਬਖਸ਼ੀ ਹੋਈ ਹੈ ਦੌੜਨ ਕਰਕੇ ਹੀ ਹਾਲ ਦੀ ਘੜੀ ਫਿਟ ਹਾਂ ਅਜੇ ਵੀ ਗਰਾਊਂਡ ਦੇ ਵਿੱਚ ਜਾਂਦੇ ਹਾਂ ਪਰ ਗਰਾਉਂਡ ਪੱਕੇ ਹੋਣ ਕਰਕੇ ਦਿੱਕਤ ਆਉਂਦੀ ਹੈ ਦੌੜਨਾ ਸਰੀਰ ਦੇ ਲਈ ਸਰੀਰ ਦੇ ਲਈ ਤੰਦਰੁਸਤੀ ਦਾ ਇੱਕ ਬਹੁਤ ਵੱਡਾ ਤੋਹਫਾ ਹੈ ਦੌੜਨਾ ਭੱਜਣਾ ਸਪਰਿੰਟ ਲਾਉਣਾ ਲੱਬੀ ਦੌੜ ਜੋਗਿੰਗ ਕਰਨਾ ਪੈਦਲ ਤੁਰਨਾ ਅਲੱਗ ਅਲੱਗ ਤਰੀਕੇ ਨੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਜਿਸ ਫਿਜੀਕਲ ਫਿਟਨੈਸ ਦੇ ਮਾਧਿਅਮ ਰਾਹੀਂ ਹੀ ਤੁਸੀਂ ਹੋਰ ਗਤੀਵਿਧੀਆਂ ਵਿੱਚ ਭਾਗ ਲੈ ਸਕਦੇ ਹੋ ਜੇਕਰ ਤੁਹਾਡਾ ਸਰੀਰ ਹੀ ਤੰਦਰੁਸਤ ਨਹੀਂ ਤਾਂ ਉੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਸੋ ਸਰੀਰ ਨੂੰ ਫਿਟ ਰੱਖਣ ਦੇ ਲਈ ਦੌੜ ਲਾਉਣੀ ਰਨਿੰਗ ਜੰਪਿੰਗ ਰੱਸਾ ਟੱਪਣਾ ਸਪਰਿੰਟ ਲਾਉਣੀ ਜੋਗਿੰਗ ਕਰਨੀ ਪੈਦਲ ਤੁਰਨਾ ਆਦਿ ਸਾਡੇ ਸਰੀਰਿਕ ਪੱਖ ਤੋਂ ਬਹੁਤ ਚੰਗੇ ਹਨ